ਬਗੀਚੀ ਬਾਰੇ ਜੋ ਹੈ ਤੁਲਨਾ ਬਗੀਚੀ ਅਸੀਂ ਆਪਦੇ ਘਰ ਦੇ ਵਿੱਚ ਹੀ ਸਬਜ਼ੀ ਵਗੈਰਾ ਸਾਂਭ ਸੰਭਾਲ ਉਹਨਾਂ ਦੀ ਖੁਦ ਹੀ ਕਰਦੇ ਹਾਂ ਆਪਣੇ ਆਪ ਹੀ ਬਾਕੀ ਇਹਦੇ ਸਾਨੂੰ ਬਹੁਤ ਫਾਇਦਾ ਹੈ ਪਹਿਲੀ ਗੱਲ ਤਾਂ ਬਗੀਚਿਆਂ ਦੇ ਵਿੱਚ ਫਲਦਾਰ ਕੋਈ ਵੀ ਵੇਲ੍ਹਾਂ ਵਗੈਰਾ ਜਿਵੇਂ ਅੰਗੂਰ ਔਰ ਘਰ ਦੇ ਵਿੱਚ ਸਬਜ਼ੀ ਚੰਗੀ ਆਪਦੇ ਘਰ ਦੇ ਵਿੱਚ ਹੀ ਅਪ ਆਪਣੇ ਹੱਥਾਂ ਨਾਲ ਹੀ ਅਸੀਂ ਕਰਦੇ ਹਾਂ ਕਿਉਂਕਿ ਘਰਾਂ ਦੇ ਵਿੱਚ ਰੂੜੀ ਦੀ ਖਾਦ ਔਰ ਸਾਰਾ ਹੀ ਜੋ ਸਾਂਭ ਸੰਭਾਲ ਹੈ ਅਸੀਂ ਖੁਦ ਹੀ ਆਪਣੇ ਆਪ ਹੀ ਆਪਣੇ ਹੱਥਾਂ ਨਾਲ ਹੀ ਕਰਦੇ ਹਾਂ ਅਤੇ ਇਹਦੇ ਵਿੱਚ ਸਾਨੂੰ ਬਹੁਤ ਫਾਇਦਾ ਹੁੰਦਾ ਹੈ ਇੱਕ ਤਾਂ ਤਾਜ਼ੀ ਸਬਜ਼ੀ ਮਿਲ ਜਾਂਦੀ ਹੈ ਦੂਜਾ ਘਰ ਦੇ ਵਿੱਚ ਇੱਕ ਪਾਸੇ ਬਗੀਚੀ ਦੇ ਵਿੱਚ ਹੀ ਫੁੱਲ ਵਗੈਰਾ ਜੋ ਕਿ ਘਰ ਦੀ ਰੌਸ਼ਨੀ ਵਗੈਰਾ ਅਤੇ ਬਹੁਤ ਸਾਂਭ ਸੰਭਾਲ ਨਾਲ ਚੰਗੇ ਵਾਤਾਵਰਣ ਦੇ ਵਿੱਚ ਬਹੁਤ ਹੀ ਚੰਗੀ ਚੀਜ਼ ਬਣ ਜਾਂਦੀ ਹੈ ਬਗੀਚੀ ਘਰ ਦੇ ਵਿੱਚ ਲਾਉਣੀ ਬਹੁਤ ਹੀ ਸੁਚੱਜ ਢੰਗ ਨਾਲ ਉਹਦੀ ਸੰਭਾਲ ਕਰਨੀ ਸਾਰੇ ਹੀ ਪਾਣੀ ਵਗੈਰਾ ਬਗੀਚੀ ਦੇ ਵਿੱਚ ਆਪ ਆਪਦੇ ਹੱਥਾਂ ਨਾਲ ਦੇਣਾ ਖਾਦ ਵਗੈਰਾ ਆਪਦੇ ਹੱਥਾਂ ਨਾਲ ਪਾਉਣੀ ਅਤੇ ਜੋ ਵੀ ਸਬਜ਼ੀ ਵਗੈਰਾ ਜਾਂ ਕੋਈ ਫਲਦਾਰ ਬੂਟੇ ਲੱਗੇ ਹੁੰਦੇ ਹਨ ਉਹ ਵੀ ਆਪਦੀ ਸੰਭਾਲ ਨਾਲ ਘਰ ਤੋਂ ਹੀ ਪੈਦਾ ਹੋ ਸਕਦੇ ਹਨ ਜਦੋਂ ਵੀ ਸਾਨੂੰ ਕੋਈ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਘਰ ਦੇ ਵਿੱਚ ਹੀ ਅਸੀਂ ਆਪਣੇ ਆਪ ਹੀ ਸਾਰੀ ਸਾਂਭ ਸੰਭਾਲ ਰੱਖ ਕੇ ਇਹਨਾਂ ਤੋਂ ਬਹੁਤ ਫਾਇਦਾ ਉਠਾਉਂਦੇ ਹਾਂ ਅਤੇ